ਫਤਿਹਗੜ੍ਹ ਸਾਹਿਬ ਜ਼ਿਲ੍ਹੇੇ ਦਾ ਵਾਤਾਵਰਨ ਬਹੁਤ ਵਧੀਆ ਹੈ ਪਰ ਇੱਥੇ ਹੁਣ ਟਰੈਫਿਕ ਦਿਨੋ ਦਿਨ ਵੱਧਦੀ ਜਾ ਰਹੀ ਹੈ ਨਵੇਂ ਨਵੇਂ ਮਾਲ ਖੁੱਲ ਰਹੇ ਹਨ ਖੇਤੀਬਾੜੀ ਜਮੀਨਾਂ ਉੱਪਰ ਘਰ ਬਣਾਏ ਜਾ ਰਹੇ ਹਨ ਅਤੇ ਕਲੋਨੀਆਂ ਕੱਟੀਆਂ ਜਾ ਰਹੀਆਂ ਹਨ ਵਾਤਾਵਰਣ ਨੂੰ ਸੰਭਾਲਣ ਲਈ ਪ੍ਰਸ਼ਾਸਨ ਵੱਲੋਂ ਦਰਖਤ ਤਾਂ ਬਹੁਤ ਲਗਾਏ ਜਾਂਦੇ ਹਨ ਪਰ ਉਹਨਾਂ ਦੀ ਸਾਰ ਸੰਭਾਲ ਪੂਰੇ ਤਰੀਕੇ ਨਾਲ ਨਹੀਂ ਕੀਤੀ ਜਾਂਦੀ ਲੋਕ ਪਬਲਿਕ ਟਰਾਂਸਪੋਰਟ ਦੀ ਬਹੁਤ ਘੱਟ ਵਰਤੋਂ ਕਰਦੇ ਹਨ ਅਤੇ ਹਰ ਕੋਈ ਆਪਣੀ ਗੱਡੀ ਰੱਖਣੀ ਅਤੇ ਆਪਣੀ ਗੱਡੀ ਦੀ ਵਰਤੋਂ ਕਰਨੀ ਪਸੰਦ ਕਰਦਾ ਹੈ ਪੁਰਾਣੀ ਨਹਿਰ ਮੀਂਹ ਦੇ ਮੌਸਮ ਵਿੱਚ ਗੰਦੇ ਨਾਲ਼ੇ ਦਾ ਰੂਪ ਧਾਰਨ ਕਰ ਲੈਂਦੀ ਹੈ ਸਾਨੂੰ ਇੱਥੇ ਦਰਖਤਾਂ ਦੀ ਦੇਖਭਾਲ ਕਰਨ ਦੀ ਲੋੜ ਹੈ ਅਤੇ ਇੱਥੇ ਸਮੇਂ ਸਮੇਂ ਅਨੁਸਾਰ ਪਬਲਿਕ ਸਥਾਨਾਂ ਦੀ ਸਾਰ ਸੰਭਾਲ ਕਰਨ ਦੀ ਲੋੜ ਹੈ ਲੋਕਾਂ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨ